ਮੈਂ ਪਿੰਨ ਮੈਂ ਪਿੰਡ ਮਾਨਾਂਵਾਲਾ ਰਹਿਣ ਰਹਿਣ ਵਾਲਾ ਹਾਂ ਮੇਰਾ ਪਿੰਡ ਮੈਨੂੰ ਬਹੁਤ ਹੀ ਪਸੰਦ ਹੈ ਮੇਰਾ ਮੇਰੀ ਜਨਮ ਤੋਂ ਹੀ ਹੋ ਕਰਕੇ ਮੇਰਾ ਇਸ ਦਾ ਨਾ ਬਹੁਤ ਅਗਮਾਹਮ ਹੈ ਮੇਰੇ ਸਭ ਦੋਸਤ ਇੱਥੇ ਦੇ ਰਹਿਣ ਵਾਲੇ ਹੈ ਬਹੁਤ ਹੀ ਚੰਗ ਚੰਗੇ ਹਨ ਮੈਂ ਉਹਨਾਂ ਨਾਲ ਬਹੁਤ ਪਿਆਰ ਕਰਦਾ ਹਾਂ ਮੇਰੇ ਮਾਤਾ ਪਿਤਾ ਵੀ ਮੈਨੂੰ ਬਹੁਤ ਪਿਆਰ ਕਰਦੇ ਹਨ ਮੈਂ ਵੀ ਉਹਨਾਂ ਨੂੰ ਬਹੁਤ ਪਿਆਰ ਕਰਦਾ ਹਾਂ ਬਾਕੀ ਸਾਡੇ ਪਿੰਡ ਦਾ ਮਾਹੌਲ ਬਹੁਤ ਵੀ ਵਧੀਆ ਹੈ ਸਭ ਮਿਲ ਜੁਲ ਕੇ ਰਹਿੰਦੇ ਰਹਿੰਦੇ ਹਨ ਇੱਥੇ ਖੇਡਾਂ ਦਾ ਵੀ ਵਧੀਆ ਪ੍ਰਬੰਧ ਹੈ ਮੈਂ ਆਪਣੇ ਦੋਸਤਾਂ ਨਾਲ ਰੋਜ਼ ਖੇਡਦਾ ਹਾਂ ਪਿੰਡ ਵਿੱਚ ਜੇ ਕਿਸੇ ਨੂੰ ਕੋਈ ਮੁਸ਼ਕਿਲ ਆ ਜਾਂਦੀ ਹੈ ਤਾਂ ਸਾਨੂੰ ਮੁਸ਼ਕਿਲ ਦੇ ਉਸ ਮੁਸ਼ਕਿਲ ਨੂੰ ਦੂਰ ਕਰ ਸਕਦੇ ਕਰਦੇ ਹਾਂ